ਹੈਲੋ ਹੈਲੋ ਹਾਂਜੀ ਗੁਰਮੀ ਸਤਿ ਸ਼੍ਰੀ ਅਕਾਲ ਮੈਡਮ ਗੁਰਮੀਤ ਮੈਡਮ ਬੋਲ ਰਹੇ ਹੈ ਅੱਛਾ ਮੈਡਮ ਚਲੋ ਵਧੀਆ ਹੋ ਗਿਆ ਮੈਂ ਹਾਂਜੀ ਮੈਡਮ ਵਧੀਆ ਹੋ ਗਿਆ ਤੁਹਾਡਾ ਨੰਬਰ ਇੱਥੇ ਟਰੂ ਕਾਲਰ 'ਤੇ ਆ ਰਿਹਾ ਸੀਗਾ ਮੈਂ ਤੁਹਾਨੂੰ ਪਹਿਚਾਣ ਲਿਆ ਮੈਂ ਤੁਹਾਡੇ ਤੋਂ ਕੁੱਛ ਚੀਜ਼ਾਂ ਪੁੱਛਣੀਆਂ ਸੀਗੀਆਂ ਕਿਉਂਕਿ ਅਸੀਂ ਨਵੇਂ ਨਵੇਂ ਆਏ ਹੈ ਅਤੇ ਸਾਨੂੰ ਇੱਥੋਂ ਦੀ ਮਾਰਕੀਟ ਵਗੈਰਾ ਦਾ ਪਤਾ ਨਹੀਂ ਹੈਗਾ ਜ਼ਿਆਦਾ ਅਤੇ ਮੈਡਮ ਗੱਲ ਇਹ ਹੈ ਕਿ ਵੀ ਅਸੀਂ ਨਵੇਂ ਘਰ 'ਚ ਸ਼ਿਫਟ ਕੀਤੇ ਹੈ ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੇਣ ਲਈ ਨਾ ਕੁਛ ਫੁਲਕਾਰੀ ਸੂਟ ਅਤੇ ਪਰਾਂਦੇ ਵਗੈਰਾ ਕੁਝ ਇਹੋ ਜਿਹੀ ਚੀਜ਼ਾਂ ਖਰੀਦਣੀਆਂ ਸੀ ਤੁਸੀਂ ਗਾਈਡ ਕਰ ਸਕਦੇ ਹੋ ਵੀ ਇੱਥੇ ਕਿਹੜੀ ਦੁਕਾਨ ਵਧੀਆ ਅਸੀਂ ਕਿੱਥੋਂ ਲੈ ਸਕਦੇ ਹਾਂ ਫੁਲਕਾਰੀ ਨਹੀਂ ਉਹ ਤਾਂ ਮੈਡਮ ਦੇਖੋ ਦੁਕਾਨਾਂ ਤਾਂ ਬਹੁਤ ਹੈ ਪਰ ਰੀਜਨੇਬਲ ਵੀ ਜਿੱਥੇ ਫਿਕਸ ਪ੍ਰਾਈਜ਼ ਹੋਵੇ ਸਹੀ ਰੇਟ 'ਚ ਚੀਜ਼ ਮਿਲ ਜਾਵੇ ਇਸ ਤਰ੍ਹਾਂ ਦੀ ਤੁਸੀਂ ਕੋਈ ਸ਼ੋਪ ਰੀਕਮੈਂਡ ਕਰੋਂਗੇ ਵੀ ਅਸੀਂ ਉੱਥੋਂ ਜਾ ਕੇ ਲੈ ਲਈਏ ਮੈਡਮ ਮੈਡਮ ਅਤੇ ਮੈਡਮ ਦੁਕਾਨ ਦਾ ਨਾਮ ਦੱਸੋ ਕਿਉਂਕਿ ਉੱਥੇ ਜਗ੍ਹਾ ਜਗ੍ਹਾ 'ਤੇ ਮੈਂ ਦੇਖਿਆ ਕਿ ਬਹੁਤ ਸਾਰੀਆਂ ਦੁਕਾਨਾਂ ਇੱਕੋ ਹੀ ਲਾਈਨ ਦੇ ਵਿੱਚ ਹੈ ਕੋਈ ਪਰਟੀਕੂਲਰ ਨਾ ਅੱਛਾ ਅੱਛਾ ਅੱਛਾ ਅੱਛਾ ਜੀ ਚਲੋ ਚਲੋ ਮੈਡਮ ਇਹ ਤਾਂ ਤੁਸੀਂ ਬਹੁਤ ਵਧੀਆ ਦੱਸਤਾ ਅਤੇ ਫਿਰ ਆਉਂਦੇ ਮੇਰੇ ਹਸਬੈਂਡ ਫਿਰ ਅਸੀਂ ਜਾਂਦੇ ਹਾਂ ਸੁਰਜੀਤ ਫੁਲਕਾਰੀ ਹਾਊਸ ਹੈ ਨਾ ਤ੍ਰਿਪੜੀ ਵਿੱਚ ਹਾਂਜੀ ਚਲੋ ਮੈਡਮ ਆਇਓ ਕਿਸੇ ਟਾਈਮ ਮਿਲਦੇ ਹਾਂ ਫਿਰ ਆਪਾਂ ਸਾਡੇ ਘਰ ਆਇਓ ਕਦੇ ਹਾਂਜੀ ਠੀਕ ਹੈ ਮੈਡਮ ਠੀਕ ਹੈ ਜੀ ਜ਼ਰੂਰ ਹਾਂਜੀ ਠੀਕ ਹੈ ਜੀ ਮੈਡਮ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਓਕੇ ਮੈਡਮ ਓਕੇ